ਜੀ ਅੱਜ ਆਪਾਂ ਗੱਲ ਕਰਦੇ ਹਾਂ ਰਾਜਨੀਕਿਪ ਰਾਜਨੀਤਿਕ ਪ੍ਰਣਾਲੀ ਦੇ ਸ਼ਕਤੀ ਦੇ ਵਿਕੇਂਦੀਕਰਨ ਦੀ ਜਿਹੜੀ ਰ ਆਪਣੀਆਂ ਸਰਕਾਰਾਂ ਨੇ ਉਹ ਮਤਲਬ ਆਪਣੀਆਂ ਪਾਵਰਾਂ ਨੂੰ ਯੂਜ ਕਰਨ ਲਈ ਵਿਕੇਂਦਰੀਕਰਨ ਕਰਦੀਆਂ ਆਪਣੀਆਂ ਪਾਵਰਾਂ ਦਾ ਉਹਦੇ ਲਈ ਕੀ ਕਰਦੀਆਂ ਨੇ ਸਰਕਾਰਾਂ ਇੱਕ ਜਗ੍ਹਾ 'ਤੇ ਬਹਿ ਕੇ ਕਿਸੇ ਵੀ ਚੀਜ਼ ਨੂੰ ਉਹ ਮੈਨੇਜ ਨਹੀਂ ਕਰ ਸਕਦੀਆਂ ਉਹਦੇ ਲਈ ਕੀ ਹੁੰਦਾ ਸਰਕਾਰ ਨੂੰ ਆਪਣੀਆਂ ਪਾਵਰਾਂ ਨੂੰ ਅਲੱਗ ਅਲੱਗ ਭਾਗਾਂ ਦੇ ਵਿੱਚ ਵੰਡਣਾ ਪੈਂਦਾ ਜਿਵੇਂ ਇੱਕ ਸਰਕਾਰ ਦਾ ਇੱਕ ਬੰਦਾ ਕੋਈ ਵੀ ਸਰਕਾਰ ਨਹੀਂ ਚਲਾ ਸਕਦਾ ਉਹਦੇ ਲਈ ਅਲੱਗ ਅਲੱਗ ਐਮ ਐਲ ਏ ਨਿਯੁਕਤ ਕੀਤੇ ਜਾਂਦੇ ਹਨ ਐਮ ਐਲ ਏ ਅੱਗੇ ਮਤਲਬ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਲੱਗ ਅਲੱਗ ਸ਼ਹਿਰਾਂ ਦੇ ਅਲੱਗ ਅਲੱਗ ਐਮ ਐਲ ਏ ਹੁੰਦੇ ਹਨ ਉਹ ਆਪਣੇ ਸ਼ਹਿਰ ਦੇ ਵਿਕਾਸ ਲਈ ਅਲੱਗ ਅਲੱਗ ਕੰਮ ਕਰਦੇ ਹਨ ਹਰੇਕ ਐਮ ਐਲ ਏ ਨੂੰ ਅਲੱਗ ਅਲੱਗ ਡਿਪਾਰਟਮੈਂਟ ਦਿੱਤਾ ਜਾਂਦਾ ਹੈ ਜਿਹਦੇ ਵਿੱਚ ਉਹ ਸ਼ਹਿਰ ਦੀਆਂ ਸਹੂਲਤਾਂ ਲਈ ਜੋ ਵੀ ਵਧੀਆ ਕੰਮ ਹੋ ਸਕਦੇ ਹੈ ਉਸ 'ਤੇ ਧਿਆਨ ਦਿ ਦਿੰਦੇ ਹਨ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਹਨ ਇਸ ਤੋਂ ਇਲਾਵਾ ਸ਼ਹਿਰ ਦੇ ਸ਼ਹਿਰਾਂ ਪਿੰਡਾਂ ਦੇ ਕਸਬਿਆਂ ਦੇ ਵਿਕਾਸ ਦੇ ਲਈ ਸਰਕਾਰ ਵੱਲੋਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਅਲੱਗ ਅਲੱਗ ਅਹੁਦਿਆਂ ਉੱਪਰ ਲਗਾਇਆ ਗਿਆ ਹੈ ਜਿਵੇਂ ਡੀ ਸੀ ਡੀ ਸੀ ਲਗਾਏ ਜਾਂਦੇ ਹਨ ਏ ਡੀ ਸੀ ਲਗਾਏ ਜਾਂਦੇ ਹਨ ਅਤੇ ਨਗਰ ਕੌਂਸਲਾਂ ਹੋ ਗਈਆਂ ਮਤਲਬ ਅਲੱਗ ਅਲੱਗ ਕੰਮ ਲੈਣ ਲਈ ਅਲੱਗ ਅਲੱਗ ਬੰਦਿਆਂ ਨੂੰ ਲਗਾਇਆ ਜਾਂਦਾ ਹੈ ਇਸਦੇ ਲਈ ਡੀ ਸੀ ਦੇ ਕੋਲ ਸ਼ਹਿਰ ਪੂਰੇ ਸ਼ਹਿਰ ਦੀ ਜ਼ਿੰਮੇਵਾਰੀ ਹੁੰਦੀ ਹੈ ਡੀ ਸੀ ਵੱਲੋਂ ਆਪਣੇ ਸ਼ਹਿਰ ਦੀ ਨਿਗਰਾਨੀ ਰੱਖੀ ਜਾਂਦੀ ਹੈ ਕੋਈ ਵੀ ਸ਼ਹਿਰ ਦੇ ਵਿੱਚ ਗੱਲਬਾਤ ਹੁੰਦੀ ਹੈ ਤਾਂ ਡੀ ਸੀ ਇਸਦੇ ਲਈ ਜ਼ਿੰਮੇਵਾਰ ਹੁੰਦਾ ਹੈ ਉਸ ਤੋਂ ਇਲਾਵਾ ਸਰਕਾਰ ਨੂੰ ਇਹਨਾਂ ਤੋਂ ਉੱਪਰ ਅਲੱਗ ਅਲੱਗ ਨਿਗਰਾਨੀ ਰੱਖਣੀ ਪੈਂਦੀ ਹੈ ਇਹਨਾਂ ਉੱਪਰ ਧਿਆਨ ਧਿਆਨ ਕਰਕੇ ਇਹਨਾਂ ਨੂੰ ਕੰਮ ਲਈ ਦੱਸਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਕਿਸ ਕਿਸ ਬੰਦੇ ਤੋਂ ਕਿਵੇਂ ਕੰਮ ਕਰਵਾਉਣਾ ਹੈ ਇਸ ਲਈ ਕੋਈ ਵੀ ਸਰਕਾਰ ਆਪਣਾ ਕੰਮ ਇੱਕ ਜਗ੍ਹਾ 'ਤੇ ਬਹਿ ਕੇ ਨਹੀਂ ਕਰ ਸਕਦੀ ਇਹਨਾਂ ਨੂੰ ਵਿਕੇਂਦਰੀਕਰਨ ਜ਼ਰੂਰੀ ਕਰਨਾ ਜ਼ਰੂਰੀ ਹੈ